ਹੈਲੋ ਮੈਮ ਮੈਂ ਸੁਖਪ੍ਰੀਤ ਸਿੰਘ ਗੱਲ ਕਰ ਰਿਹਾ ਹੇਅਰ ਮਾਸਟਰ ਸੈਲੂਨ ਤੋਂ ਪਟਿਆਲਾ ਤੋਂ ਤੁਸੀਂ ਸਾਡੀ ਵੈਬਸਾਈਟ 'ਤੇ ਇਨਕੁਆਇਰੀ ਪਾਈ ਸੀ ਮੈਮ ਮੈਮ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ ਹਾਂਜੀ ਮੈਮ ਜ਼ਰੂਰ ਮੈਮ ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਬਟੋਕਸ ਜਾਂ ਫਿਰ ਕੈਰੇਟੀਨ ਜਾਂ ਸਮੂਦਨਿੰਗ ਕਰਵਾ ਸਕਦੇ ਹੋ ਮੈਮ ਜ਼ਰੂਰ ਮੈਮ ਕੈਰੇਟੀਨ ਸਾਡੇ ਸੁੱਕੇ ਵਾਲਾਂ ਨੂੰ ਸਾਫ਼ ਅਤੇ ਸਮੂਦ ਬਣਾਉਣ ਵਿੱਚ ਮਦਦ ਕਰਦਾ ਮੈਮ ਅਤੇ ਸਟੇਟ ਵੀ ਕਰਦਾ ਬਟੋਕਸ ਸਾਡੇ ਡੈਮੇਜ ਵਾਲਾਂ ਨੂੰ ਸਮੂਥ ਅਤੇ ਗਲੋਸੀ ਬਣਾ ਦਿੰਦਾ ਜ਼ਰੂਰ ਮੈਮ ਹਾਂਜੀ ਮੈਮ ਸਾਡੇ ਕੋਲ ਕੈਰੇਟੀਨ ਵਾਰ ਵਾਰਜਕੋ ਵਾਜਕੋ ਅਤੇ ਲੋਰੀਅਲ ਅਤੇ ਟ੍ਰੇਸਮੇ ਆ ਮੈਮ ਇਹਦਾ ਰਿਜਲਟ ਬਾਕੀ ਸਾਰਿਆਂ ਤੋਂ ਤਿੰਨ ਗੁਣਾ ਜ਼ਿਆਦਾ ਤਿੰਨ ਹਜ਼ਾਰ ਰੁਪਏ ਮੈਮ ਕੀ ਤੁਸੀਂ ਕਟਿੰਗ ਜਾਂ ਹੇਅਰ ਕਰਲਰਿੰਗ ਕਰਵਾਉਣਾ ਚਾਹੋਗੇ ਠੀਕ ਹੈ ਮੈਮ ਉਹਦੇ ਐਡੀਸ਼ਨਲ ਚਾਰਜਿਸ ਹੋਣਗੇ ਢਾਈ ਸੌ ਰੁਪਇਆ ਜ਼ਰੂਰ ਮੈਮ ਕਿਸ ਸਮੇਂ ਤੁਸੀਂ ਆਉਣਾ ਚਾਹੋਗੇ ਠੀਕ ਆ ਮੈਮ ਤੁਸੀਂ ਆਪਣਾ ਨਾਮ ਦੱਸ ਦਿਓ ਓਕੇ ਥੈਂਕ ਯੂ ਮੈਮ ਬਾਈ ਨੰਬਰ ਫਾਟਕ ਤਰਿੱਪੜੀ ਪਟਿਆ ਓ ਪਟਿਆਲਾ ਜੀ